ਮੈਂ ਪੰਜਾਬ ਵਿੱਚ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਕਲਾ ਅਤੇ ਸ਼ਿਲਪਕਾਰੀ ਦੀ ਭੂਮਿਕਾ ਦਾ ਵਰਣਨ ਵੱਖ ਵੱਖ ਕਈ ਤਰੀਕਿਆਂ ਨਾਲ ਕਰ ਸਕਦੀ ਹਾਂ ਮੈਂ ਉਹਨਾਂ ਦੇ ਮਿੱਟੀ ਦੇ ਪੁਤਲੇ ਅਖਬਾਰ ਨਾਲ ਪੁਤਲੇ ਬਣਾ ਕੇ ਜਾਂ ਹੋਰ ਵੀ ਕਈ ਅ ਬੇਕਾਰ ਚੀਜ਼ਾਂ ਦੇ ਪੁਤਲੇ ਵਗੈਰਾ ਬਣਾ ਕੇ ਉਹਨਾਂ ਨੂੰ ਰਸਮਾਂ ਕਰਦੇ ਹੋਏ ਦਿਖਾ ਸਕਦੀ ਹਾਂ ਜਿਵੇਂ ਵਿਆਹ ਵਿੱਚ ਕਿਵੇਂ ਵੱਖ ਵੱਖ ਰਸਮਾਂ ਕੀਤੀਆਂ ਜਾਂਦੀਆਂ ਹਨ ਮੁੰਡਾ ਜੰਮਣ 'ਤੇ ਕਿਦ ਕਿਵੇਂ ਰਸਮਾਂ ਕੀਤੀਆਂ ਜਾਂਦੀਆਂ ਹਨ ਮੈਂ ਅਲੱਗ ਅਲੱਗ ਤਿਉਹਾਰ ਵੀ ਦਿਖਾ ਸਕਦੀ ਹਾਂ ਕਿ ਕਿਵੇਂ ਹੋਲੀ ਖੇਡਦੇ ਹਨ ਦੀਵਾਲੀ ਖੇ ਕਰਦੇ ਆ ਕ ਮਨਾਉਂਦੇ ਹਨ ਲੋਹੜੀ ਮਨਾਉਂਦੇ ਹਨ ਔਰ ਅਸੀਂ ਮਿੱਟੀ ਦੇ ਕਾਫੀ ਸਾਰੇ ਘਰ ਮਿੱਟੀ ਦੇ ਪੁਤਲੇ ਵੀ ਬਣਾ ਸਕਦੇ ਹਾਂ ਔਰ ਪਿੰਡਾਂ ਦਾ ਮਾਹੌਲ ਬਣਾ ਸਕਦੇ ਹਾਂ ਉੱਥੇ ਦੇ ਘਰੇਲੂ ਜ ਕਿਆ ਕਿਆ ਉਹ ਕੰਮ ਕਰਦੇ ਹਨ ਚੁੱਲ੍ਹਾ ਚੌਕਾ ਕਿਵੇਂ ਸਫ਼ਾਈ ਕਰਦੇ ਹਨ ਅਤੇ ਜਿਵੇਂ ਕਿ ਉੱਥੇ ਦੀਆਂ ਜਨਾਨੀਆਂ ਕਿਵੇਂ ਘਰੇਲੂ ਕੰਮ ਕਰਦੀਆਂ ਹਨ ਸਾਰਾ ਅਸੀਂ ਮਿੱਟੀ ਦੇ ਪੁਤਲੇ ਬਣਾ ਕੇ ਵੀ ਪਿੰਡ ਦਾ ਮਾਹੌਲ ਬਣਾ ਕੇ ਵੀ ਦਿਖਾ ਸਕਦੇ ਹਾਂ